ਸਾਡੇ ਇੱਥੇ ਆਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਅਤੇ ਇਹ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਿੱਥੇ ਨਿਹੰਗ ਸਿੰਘ ਆਪਣੇ ਜੌਹਰ ਵਿਖਾਉਂਦੇ ਨੇ ਅਤੇ ਬੜੀ ਅਪਾਰ ਕਿਰਪਾ ਹੈ ਗੁਰੂ ਬਾਜਾਂ ਵਾਲੇ ਪਿਤਾ ਦੀ ਅਤੇ ਸਾਡੇ ਇੱਥੇ ਸਮਾਗਮ ਜਿਹੜੇ ਮਨਾਏ ਜਾਂਦੇ ਨੇ ਸ਼ਹੀਦੀ ਸਮਾਗਮ ਜੋੜ ਮੇਲਾ ਉਹ ਧੰਨ ਬਾਬਾ ਜ਼ੋਰਾਵਰ ਧੰਨ ਬਾਬਾ ਫਤਿਹ ਸਿੰਘ ਧੰਨ ਮਾਤਾ ਗੁਜਰ ਕੌਰ ਜੀ ਦੀ ਯਾਦ ਦੇ ਵਿੱਚ ਤਿੰਨ ਦਿਨ ਜੋੜ ਮੇਲਾ ਮਨਾਇਆ ਜਾਂਦਾ ਹੈ ਅਨੇਕਾਂ ਪ੍ਰਕਾਰ ਦੇ ਲੰਗਰ ਲਾਏ ਜਾਂਦੇ ਨੇ ਜਿੱਥੇ ਰਾਗੀ ਢਾਡੀ ਆ ਕੇ ਹਰਿ ਜੱਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਅਤੇ ਨਗਰ ਕੀਰਤਨ ਵੀ ਕੱਢੇ ਜਾਂਦੇ ਨੇ ਅਤੇ ਹੋਰ ਜਿਹੜੇ ਤਿਉਹਾਰ ਨੇ ਸਾਡੇ ਸਮਾਗਮ ਨੇ ਜਿਹੜੇ ਗੱਤਕਾ ਹੋ ਗਿਆ ਅਤੇ ਹੋਰ ਜਿਹੜੇ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੇ 'ਤੇ ਗੁਰਗੱਦੀ ਦਿਵਸ ਹੋ ਗਿਆ ਅਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਤਿਉਹਾਰ ਆ ਸਾਡੇ ਮਨਾਏ ਜਾਂਦੇ ਨੇ ਵਿਸਾਖੀ ਹੋ ਗਈ ਜਿੱਦਾਂ ਦੀਵਾਲੀ ਹੋ ਗਈ ਜੋ ਸਾਡੇ ਮਤਲਬ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਉੱਤੇ ਸੰਗਤ ਦੂਰੋਂ ਦੂਰੋਂ ਆ ਕੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਨੇ ਦੀਪਾਵਲੀ ਛੇਵੇਂ ਪਾਤਸ਼ਾਹ ਯਾਦ ਦੇ ਵਿੱਚ ਮਨਾਈ ਜਾਂਦੀ ਹੈ ਸੋ ਸੰਗਤਾਂ ਨਤਮਸਤਕ ਕਰਨ ਆਉਂਦੀਆਂ ਨੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਸਾਡਾ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਜੋ ਪੰਜਾਬ ਦਾ ਜੋ ਤਿਉਹਾਰ ਨੇ ਸਮਾਗਮ ਨੇ ਤਿੱਥ ਨੇ ਇਹ ਬੜੀ ਸ਼ਰਧਾ ਦੇ ਨਾਲ ਮਨਾਏ ਜਾਂਦੇ ਨੇ ਅਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੂੰ ਯਾਦ ਵੀ ਕੀਤਾ ਜਾਂਦਾ ਹੈ ਅਤੇ ਸੰਗਤਾਂ ਦੂਰੋਂ ਦੂਰੋਂ ਆ ਕੇ ਦਰਸ਼ਨ ਵੀ ਕਰਦੀਆਂ ਨੇ ਜਿਹੜੇ ਸਮਾਗਮ ਨੇ ਜਿਹੜੇ ਤਿਉਹਾਰ ਨੇ ਬੜੀ ਭਾਵਨਾ ਦੇ ਨਾਲ ਮਨਾਏ ਜਾਂਦੇ ਨੇ ਅਤੇ ਸੰਗਤ ਬੜੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸੇਵਾ ਵੀ ਕਰਦੀ ਹੈ